ਦਸ ਮਾਰਚ ਉੱਨੀ ਸੌ ਸਤਾਸੀ ਛੇ ਦਸੰਬਰ ਦੋ ਹਜ਼ਾਰ ਅੱਠ ਇੱਕ ਫਰਵਰੀ ਦੋ ਹਜ਼ਾਰ ਨੌਂ ਛੇ ਮਾਰਚ ਉੱਨੀ ਸੌ ਤੇਹੱਤਰ ਇੱਕ ਜਨਵਰੀ ਉੱਨੀ ਸੌ ਨੱਬੇ